ਸਾਡੇ ਖੇਤਰ ਵਿੱਚ ਲਗਭਗ ਹਰੇਕ ਬਰਾਂਡ ਬਰਾਂਡ ਹੈ ਅਤੇ ਲੋਕ ਜ਼ਿਆਦਾਤਰ ਸਮਾਰਟਫੋਨ ਦੀ ਵਰਤੋਂ ਕਰਦੇ ਹਨ ਕਿਉਂਕਿ ਇਸ ਨੂੰ ਚਲਾਉਣਾ ਬਹੁਤ ਅਸਾਨ ਹੈ ਮੇਰੇ ਕੋਲ ਸੈਮਸੰਗ ਦਾ ਫੋਨ ਹੈ ਇਸ ਦਾ ਕੈਮਰਾ ਅਤੇ ਮੈਮਰੀ ਬਹੁਤ ਵਧੀਆ ਹੈ ਇਸ ਨੂੰ ਇਸ ਤੋਂ ਕਿਉਂਕਿ ਇਹ ਮੇਰੀ ਹਰ ਤਰ੍ਹਾਂ ਦੀ ਲੋੜ ਪੂਰੀ ਕਰਦਾ ਹੈ ਇਸਦਾ ਕੈਮਰਾ ਬਹੁਤ ਵਧੀਆ ਹੈ ਤਸਵੀਰਾਂ ਖਿੱਚਦਾ ਹੈ ਕੋਲਿੰਗ ਵੀ ਬਹੁਤ ਚੰਗੀ ਹੈ ਇਸ ਵਿੱਚ ਫੋਟੋ ਚੰਗੀ ਤਰ੍ਹਾਂ ਸਾਫ਼ ਦਿਖਾਈ ਦਿੰਦੀਆਂ ਹਨ ਹਰੇਕ ਹੈੱਡਫੋਨ ਜੁੜਦੇ ਹਨ ਬਲੂਟੁੱਥ ਰਾਹੀਂ ਹੋਰ ਵੀ ਦੋ ਸ ਇਸ ਵਿੱਚ ਦੋ ਸਿੰਮ ਪੈਂਦੇ ਹਨ ਉਹ ਵੀ ਬਹੁਤ ਵਧੀਆ ਕੋਲਿੰਗ ਕਰਦੇ ਹਨ